ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਸਿਹਤ ਸੰਭਾਲ ਨੂੰ ਅੱਜ ਕੱਲ੍ਹ ਰਿਵਾਇਤੀ ਦਵਾਈ ਨਾਲ ਇਸ ਕਰਕੇ ਜੋੜਿਆ ਗਿਆ ਹੈ ਕਿਉਂਕਿ ਅੱਜ ਕੱਲ੍ਹ ਜੋ ਰਵਾਇਤੀ ਦਵਾਈਆਂ ਹਨ ਉਹ ਬਹੁਤ ਹੀ ਪੁਰਾਣੇ ਢੰਗਾਂ ਨਾਲ ਬਣਾਈਆਂ ਜਾਂਦੀਆਂ ਹਨ ਜਿਹਨਾਂ ਵਿੱਚ ਕਈ ਜੜੀ ਬੂਟੀਆਂ ਮਿਲਾਈਆਂ ਜਾਂਦੀਆਂ ਹਨ ਜੋ ਸਾਡੇ ਸਰੀਰ ਲਈ ਬਹੁਤ ਹੀ ਲਾਹੇਬੰਦ ਸਿੱਧ ਹੁੰਦੀਆਂ ਹਨ ਅਤੇ ਸਾਡੇ ਸਰੀਰ ਲਈ ਕੋਈ ਨੁਕਸਾਨ ਨਹੀਂ ਹੁੰਦੀਆਂ ਅੱਜ ਦੀਆਂ ਮੈਡੀਕਲ ਦਵਾਈਆਂ ਜੋ ਕਿ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਕਈ ਦਵਾਈਆਂ ਸਾਡੇ ਸਰੀਰ ਨੂੰ ਇਮਿਊਨਿਟੀ ਸਿਸਟਮ ਨੂੰ ਵੀ ਕਮਜ਼ੋਰ ਕਰਦੀਆਂ ਹਨ ਇਸ ਲਈ ਪੰਜਾਬ ਵਿੱਚ ਸਿਹਤ ਸੰਭਾਲ ਨੂੰ ਰਵਾਇਤੀ ਦਵਾਈ ਨਾਲ ਜੋੜਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਅਤੇ ਇਸ ਨਾਲ ਦਰਖਤਾਂ ਅਤੇ ਜੰਗਲਾਂ ਦੀ ਰੱਖਿਆ ਹੋਵੇਗੀ ਕਿਉਂਕਿ ਜੇਕਰ ਅਸੀਂ ਜੜੀ ਬੂਟੀਆਂ ਤੋਂ ਦਵਾਈਆਂ ਬਣਾਵਾਂਗੇ ਤਾਂ ਅਸੀਂ ਫਿਰ ਵੱਧ ਤੋਂ ਵੱਧ ਦਰਖਤ ਵੀ ਲਗਾਵਾਂਗੇ ਧੰਨਵਾਦ